ਹਾਂ ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਹੈ ਮੈਂ ਸਾਰਾ ਦਿਨ ਖਾਣਾ ਬਣਾਉਣ ਵਿੱਚ ਨ ਖਪਤ ਕਰ ਸਕਦੀ ਹਾਂ ਮੈਂ ਤਿੰਨ ਟਾਈਮ ਖਾਣਾ ਬਣਾਉਂਦੀ ਹਾਂ ਮੇਰਾ ਬਣਾਇਆ ਹੋਇਆ ਭੋਜਨ ਮੇਰੇ ਬੱਚਿਆਂ ਨੂੰ ਅਤੇ ਮੇਰੇ ਮੇਰੀ ਪੂਰੀ ਫੈਮਿਲੀ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਵੀ ਬਹੁਤ ਪਸੰਦ ਆਉਂਦਾ ਹੈ ਬਿਨਾਂ ਰੈਸਿਪੀ ਤੋਂ ਮੈਂ ਕੇਕ ਬਣਾਇਆ ਸੀ ਜੋ ਕਿ ਬਹੁਤ ਹੀ ਵਧੀਆ ਬਣਿਆ ਸੀ ਮੇਰੇ ਬੱਚੇ ਸਕੂਲ ਲੈ ਕੇ ਗਏ ਮੇਰੇ ਬੱਚਿਆਂ ਨੇ ਆਪਣੇ ਦੋਸਤਾਂ ਨੂੰ ਵੀ ਖਵਾਇਆ ਉਹਨਾਂ ਨੂੰ ਵੀ ਇਹ ਬਣਾਇਆ ਹੋਇਆ ਕੇਕ ਬਹੁਤ ਪਸੰਦ ਆਇਆ ਉਹ ਰੋਜ਼ ਕਹਿੰਦੇ ਨੇ ਕਿ ਮੰਮਾ ਸਾਨੂੰ ਆਹ ਰਐਸਪੀ ਆਹ ਕੇਕ ਸਾਨੂੰ ਬਣਾ ਕੇ ਦਿਓ ਮੈਂ ਸਕੂਲ ਲੈ ਕੇ ਜਾਣਾ ਹੈ ਮੇਰੇ ਫਾਦਰ ਮਦਰ ਬਰਦਰ ਸਿਸਟਰ ਉਹਨਾਂ ਨੂੰ ਵੀ ਮੇਰਾ ਬਣਾਇਆ ਹੋਇਆ ਖਾਣਾ ਰੋਜ਼ ਖਾਣ ਦੀ ਆਦਤ ਹੈ ਅਤੇ ਉਹ ਮੇਰੇ ਹੱਥ ਦਾ ਬਣਿਆ ਹੋਇਆ ਭੋਜਨ ਹੀ ਖਾਂਦੇ ਹਨ